ਧਰਮ ਧਰਮ ਦੀ ਸਾਡੇ ਸਮਾਜ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ ਜਿਵੇਂ ਕਿ ਅਸੀਂ ਵੱਖ ਵੱਖ ਧਰਮਾਂ ਵਾਲੇ ਸਮਾਜ ਵਿੱਚ ਰਹਿੰਦੇ ਹਾਂ ਜਿਵੇਂ ਕਿ ਹਿੰਦੂ ਧਰਮ ਸਿੱਖ ਧਰਮ ਆਦਿ ਹੋਰ ਇਹ ਧਰਮ ਸਾਨੂੰ ਜੀਵਨ ਵਿੱਚ ਚੰਗੇ ਨਾਗਰਿਕ ਦੀ ਤਰ੍ਹਾਂ ਰਹਿਣਾ ਸਿਖਾਉਂਦੇ ਹਨ ਇਹ ਧਰਮ ਸਾਨੂੰ ਦੱਸਦੇ ਹਨ ਕਿ ਇੱਕ ਚੰਗਾ ਇਨਸਾਨ ਕਿਵੇਂ ਰਹਿੰਦਾ ਹੈ ਜਿਵੇਂ ਕਿ ਸਿੱਖ ਧਰਮ ਵਿੱਚ ਦੱਸਿਆ ਗਿਆ ਹੈ ਕਿ ਸਵੇਰੇ ਉੱਠ ਕੇ ਸਾਨੂੰ ਪਾਠ ਕਰਨਾ ਚਾਹੀਦਾ ਹੈ ਸਵੇਰੇ ਉੱਠਣ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਸਾਨੂੰ ਚੰਗੀ ਆਦਤ ਪੈਂਦੀ ਹੈ ਅਤੇ ਅਸੀਂ ਸਾਰਾ ਦਿਨ ਹਰ ਕੰਮ ਬੜੀ ਨਿਪੁੰਨਤਾ ਨਾਲ ਕਰ ਸਕਦੇ ਹਾਂ ਹਰੇਕ ਧਰਮ ਵਿੱਚ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਚੰਗੀਆਂ ਆਦਤਾਂ ਅਪਣਾਉਣਾ ਸਭ ਤੋਂ ਵਧੀਆ ਹੈ ਜਿਸ ਨਾਲ ਅਸੀਂ ਆਪਣੇ ਜੀਵਨ ਦਾ ਹਰ ਲਕਸ਼ ਪ੍ਰਾਪਤ ਕਰ ਸਕਦੇ ਹਾਂ ਧਰਮ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਕਿ ਅਸੀਂ ਆਪਣੇ ਧਰਮ ਵਿੱਚ ਕੋਈ ਵੀ ਕੰਮ ਕਿਵੇਂ ਇਮਾਨਦਾਰੀ ਨਾਲ ਕਰਨਾ ਹੈ ਕਿਵੇਂ ਕਿਸੇ ਨਾਲ ਬੋਲਣਾ ਹੈ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਕਿਸੇ ਨਾਲ ਵੀ ਅਹਿੰਸਾ ਆਦਿ ਵਰਗੇ ਬੁਰੇ ਕੰਮ ਨਹੀਂ ਕਰਨੇ ਇਸ ਕਰਕੇ ਸਾਨੂੰ ਆਪਣੇ ਧਰਮ ਦੇ ਪੱਖ ਵਿੱਚ ਹੀ ਹੋਣਾ ਚਾਹੀਦਾ ਹੈ ਇਸ ਕਰਕੇ ਕਿ ਅਸੀਂ ਇੱਕ ਚੰਗੇ ਨਾਗਰਿਕ ਬਣ ਸਕੀਏ ਅਸੀਂ ਅਨੇਕਾਂ ਧਰਮਾਂ ਵਾਲੇ ਦੇਸ਼ ਵਿੱਚ ਵੀ ਏਕਤਾ ਬਣਾ ਕੇ ਰਹਿੰਦੇ ਹਾਂ ਇਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਇਨਸਾਨ ਵੱਖ ਨਹੀਂ ਹੁੰਦਾ ਸਭ ਇੱਕ ਹੀ ਰੱਬ ਦੇ ਬਣਾਏ ਹੋਏ ਹਨ ਇਸ ਕਰਕੇ ਸਾਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ